ਹੈਲੋ ਤੁਸੀਂ ਲਵਲੀ ਵੈੱਜ ਚਾਂਪ ਤੋਂ ਬੋਲ ਰਹੇ ਹੋ ਅੱਜ ਕੀ ਸਪੈਸ਼ਲ ਬਣਾਇਆ ਤੁਸੀਂ ਹਾਂਜੀ ਮਲਾਈ ਚਾਂਪ ਅਤੇ ਰੁਮਾਲੀ ਫੁਲਕਾ ਹਾਂਜੀ ਅੱਜ ਮੇਰੇ ਪਾਰਟੀ ਸੀ ਇੱਕ ਮੇਰੇ ਪੰਜਾਹ ਕੁ ਦੋਸਤ ਆਉਣੇ ਨੇ ਅਤੇ ਮੈਂ ਤੁਹਾਨੂੰ ਔਡਰ ਦੇਣਾ ਸੀਗਾ ਉਸ ਚੀਜ਼ ਦਾ ਹਾਂਜੀ ਹਾਂਜੀ ਤੁਸੀਂ ਅੱਜ ਐਕਸਟਰਾ ਕੁਛ ਜ਼ਿਆਦਾ ਲਾਰਜ ਬਣਾ ਲੈਣਾ ਵੀ ਤੇ ਸ਼ਾਮ ਤੱਕ ਮੈਨੂੰ ਮਿਲ ਜਾਏਗਾ ਹਾਂਜੀ ਹਾਂਜੀ ਵਧੀਆ ਤਰੀਕੇ ਨਾਲ ਬਣਾਉਣਾ ਠੀਕ ਹਾਂਜੀ ਹਾਂਜੀ ਹਾਂਜੀ ਅੱਜ ਚਾਹੀਦਾ ਜੀ ਸ਼ਾਮੀ ਪਾਰਟੀ ਆ ਜੀ ਤਾਂ ਕਰਕੇ ਤੁਹਾਨੂੰ ਔਡਰ ਦੇ ਰਿਹਾ ਅਤੇ ਇਹਦੇ ਉੱਤੇ ਕੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਹਾਂਜੀ ਤੁਹਾਡੇ ਪੱਕੇ ਕਸਟਮਰ ਹਾਂ ਜੀ ਡਿਸਕਾਊਂਟ ਤਾਂ ਬਣਦਾ ਜੀ ਹਾਂਜੀ ਹਾਂਜੀ ਥਰਟੀ ਪਰਸੈਂਟ ਤੱਕ ਡਿਸਕਾਊਂਟ ਮਿਲ ਜੇਗਾ ਠੀਕ ਆ ਜੀ ਹਾਂਜੀ ਸ਼ਾਮ ਤੱਕ ਮੈਨੂੰ ਮਿਲ ਜਾਣਾ ਚਾਹੀਦਾ ਔਡਰ ਜੀ ਓਕੇ ਜੀ